ਪੰਜਾਬੀ ਭਾਸ਼ਾ ਇੱਕ ਬਹੁਤ ਹੀ ਪਿਆਰੀ ਭਾਸ਼ਾ ਹੈ ਅਤੇ ਜਦੋਂ ਵੀ ਕੋਈ ਪੰਜਾਬੀ ਕਿਸੇ ਨਾਲ ਪੰਜਾਬੀ ਨਾਲ ਗੱਲ ਕਰਦਾ ਏ ਤਾਂ ਇਵੇਂ ਲੱਗਦਾ ਕਿ ਜਿਵੇਂ ਕੋਈ ਮਿਸ਼ਰੀ ਜਾਂ ਖੰਡ ਘੋਲਦਾ ਹੋਵੇ ਅਤੇ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਹ ਏ ਆਪਣੀ ਜਿਹੜੀ ਪੰਜਾਬੀ ਮਤਲਬ ਪੰਜਾਬੀ ਭਾਸ਼ਾ ਹੈ ਉਹਨਾਂ ਦੀ ਮ ਮਾਂ ਬੋਲੀ ਉਹਨਾਂ ਦੀ ਪਰ ਅੱਜ ਕੱਲ੍ਹ ਹੋ ਕੀ ਰਿਹਾ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਕੀ ਕਰਦੀ ਹੈ ਕੀ ਉਹ ਪੰਜਾਬੀ ਆਪਣੀ ਮਾਂ ਬੋਲੀ ਨੂੰ ਬੋਲਦੇ ਹੋਏ ਸੰਗਦੇ ਨੇ ਅਤੇ ਉਹਨਾਂ ਨੂੰ ਲੱਗਦਾ ਕਿ ਜਿਹੜੀ ਅੰਗਰੇਜ਼ੀ ਭਾਸ਼ਾ ਏ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਆਪਾਂ ਕਹਿੰਦੇ ਹਾਂ ਅਤੇ ਉਹਨੂੰ ਬੋਲਣ 'ਤੇ ਥੋੜਾ ਉਹ ਜਿਆਦਾ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਉਹਨੂੰ ਬੋਲ ਕੇ ਇੱਦਾਂ ਥੋੜਾ ਮੰਨਦੇ ਨੇ ਕਿ ਅਸੀਂ ਜਾਂ ਤਾਂ ਵੱਡੇ ਹੋ ਗਏ ਜਾਂ ਸਾਨੂੰ ਬਹੁਤ ਸਾਨੂੰ ਗਿਆਨ ਹੈ ਅਤੇ ਲੱਗਦਾ ਉਹਨੂੰ ਕਿ ਜਿਹੜਾ ਇਹਦਾ ਹੱਲ ਹੈ ਮੇਰੀ ਭਾਰਤ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਿਵੇਂ ਇਹਦਾ ਜਿਹੜਾ ਪੜ੍ਹਾਈ ਦਾ ਮਤਲ ਇਹਨੂੰ ਪੜ੍ਹਾਇਆ ਜਾਂਦਾ ਪੰਜਵੀਂ ਤੋਂ ਸੱਤਵੀਂ ਅੱਠਵੀਂ ਤੱਕ ਪੜ੍ਹਾਇਆ ਜਾਂਦਾ ਏ ਅਤੇ ਮੇਰੀ ਅਪੀਲ ਇਹੀ ਰਹੂਗੀ ਸਰਕਾਰ ਨੂੰ ਕਿ ਜਿਹੜੀ ਪੰਜਾਬੀ ਭਾਸ਼ਾ ਇਹਦਾ ਵਿਸ਼ਾ ਏ ਉਹ ਗ੍ਰੈਜੂਏਟ ਤੱਕ ਹੋਣਾ ਚਾਹੀਦਾ ਏ